ਹੈਲੋ ਹਾਂਜੀ ਸੰਦੀਪ ਜੀ ਕੀ ਹਾਲ ਆ ਜੀ ਸੰਦੀਪ ਜੀ ਮੈਂ ਤ ਤੁਹਾਡੇ ਤੋਂ ਆਡਰ ਕੀਤਾ ਸੀ ਜਿਹੜੀ ਇੱਕ ਮੈਂ ਸਵੈਟਰ ਲਈ ਸੀ ਵਰਧਮਾਨ ਵੂਲ ਦੀ ਉਹ ਮੇ ਆਡਰ ਦੇ ਨਾਲ ਹੀ ਦੂਜੇ ਦਿਨ ਮੈਨੂੰ ਮਿਲ ਗਈ ਸੀ ਜਿਹੜੀ ਜਿਹੜੀ ਮੈਂ ਪਾਇਆ ਕਿ ਬਹੁਤ ਖੁਸ਼ ਸੀ ਉਸਦਾ ਕਲਰ ਉਹਦਾ ਵ ਸੋਫਟ ਵੂਲ ਸੀ ਅਤੇ ਪ ਮੈਂ ਲ ਰੈਗੂਲਰ ਪ ਆਪਣੇ ਡਿਪਾਰਟਮੈਂਟ ਪਾ ਕੇ ਜਾ ਰਿਹਾ ਸੀ ਅਤੇ ਉਸੇ ਮੈਨੂੰ ਕ ਮੈਨੂੰ ਬੜੀ ਵਧ ਵਧੀਆ ਲੱਗੀ ਤੁਹਾਡੀ ਇਹ ਵੋਲ ਵਾਲੀ ਸਵੈਟਰ ਮੈਂ ਇਹ ਦੇਖ ਕੇ ਮੈਂ ਰ ਸੈਕਿੰਡ ਤੁਹਾਡੇ ਅੱਗੇ ਪ ਪ ਪ੍ਰੋਡਕਟ ਮੈਨੂੰ ਸੈਟਰ ਚਾਹੀਦੀ ਸੀ ਪ੍ਰੋਡਕਟ ਦੁਬਾਰਾ ਤੁਹਾਨੂੰ ਕ ਕੀਤਾ ਪਰ ਉਹਦਾ ਪ੍ਰੋਡਕਟ ਤੁਹਾਡਾ ਮੈਨੂੰ ਕ ਕਾਫੀ ਦ ਬਾਰਾਂ ਤੇਰਾਂ ਦਿਨਾਂ ਬਾਅਦ ਮਿਲਿਆ ਨਾਲੇ ਜਿਹੜਾ ਤੁਹਾਨੂੰ ਕਲਰ ਕਿਹਾ ਸੀ ਉਹ ਕਲਰ ਵੀ ਮੈਨੂੰ ਕਾਫੀ ਫੇਡ ਅਤੇ ਹੋਰ ਕਲਰ ਦੇ ਤਾ ਜਦੋਂ ਮੈਂ ਉਹ ਕ ਸਵੈਟਰ ਪਹਿਨੀ ਮੈਨੂੰ ਤਾਂ ਬੜਾ ਗ਼ਲਤ ਫੀਲਿੰਗ ਆਈ ਕਿ ਕਿ ਜੋ ਮੈਂ ਕਹਿਣਾ ਚਾਹੁੰਦਾ ਸੀ ਉਹ ਚੀਜ਼ ਤੁਸੀਂ ਮੈਨੂੰ ਨਹੀਂ ਦੇ ਸਕੇ ਕਿਰਪਾ ਕਰਕੇ ਜਿਹੜਾ ਤੁਸੀਂ ਦੂਜਾ ਪ੍ਰੋਡਕਟ ਦਿੱਤਾ ਹੈ ਇਸ ਨੂੰ ਤੁਸੀਂ ਵਾਪਸ ਲੈ ਲਉ ਤਾਂ ਜੋ ਮੈਨੂੰ ਸਹੀ ਤਰੀਕੇ ਦੀ ਚੀਜ਼ ਦਿੱਤੀ ਜਾਵੇ ਅਤੇ ਮੈਂ ਆਪ ਜੀ ਦਾ ਬਹੁਤ ਆਭਾਰੀ ਹਾਂ